ਆਟੋ ਮੋਬਾਇਲ ਇੰਡਸਟਰੀ ਆਟੋ ਮੋਬਾਇਲ ਇੰਡਸਟਰੀ ਨੇ ਵੀ ਸਾਡੇ ਕੇਂਦਰ ਸ਼ਾਸਤ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਇਸ ਨਾਲ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ ਸਾਨੂੰ ਇੱਕ ਥਾਂ ਤੋਂ ਦੂਜੇ ਥਾਂ ਵਿੱਚ ਸਮਾਨ ਲਿਜਾਉਣ ਵਿੱਚ ਕੋਈ ਦਿੱਕਤ ਨਹੀਂ ਅੱਜ ਕੱਲ੍ਹ ਸਾਡੇ ਕੋਲ ਇੰਨਾ ਆਟੋ ਮੋਬਾਇਲ ਹੋ ਗਿਆ ਹੈ ਜਿਸ ਨਾਲ ਅਸੀਂ ਕਿਤੇ ਵੀ ਕੋਈ ਵੀ ਸਮਾਨ ਛੇਤੀ ਤੋਂ ਛੇਤੀ ਪਹੁੰਚਾ ਸਕਦੇ ਹਾਂ ਸਿਹਤ ਨਾਲ ਸੰਬੰਧਿਤ ਸਾਡਾ ਅੱਜ ਕੱਲ੍ਹ ਪੰਜਾਬ ਵਿੱਚ ਕਈ ਇਹੋ ਜਿਹੇ ਏਮਜ਼ ਖੁੱਲ੍ਹ ਚੁੱਕੇ ਹਨ ਜੋ ਕਿ ਪਿੰਡਾਂ ਵਿੱਚ ਵੀ ਹਨ ਅਤੇ ਅੱਜ ਕੱਲ੍ਹ ਪੇਂਡੂ ਲੋਕਾਂ ਨੂੰ ਸ਼ਹਿਰਾਂ ਵਿੱਚ ਨਹੀਂ ਜਾਣਾ ਪੈਂਦਾ ਅਤੇ ਗਰੀਬ ਲੋਕਾਂ ਨੂੰ ਵੀ ਸਿਹਤ ਸਹੂਲਤਾਂ ਉੱਥੋਂ ਪ੍ਰਦਾਨ ਹੁੰਦੀਆਂ ਹਨ ਅਤੇ ਹੁਣ ਸਾਡੇ ਪੰਜਾਬ ਵਿੱਚ ਇੱਕ ਏਮਜ਼ ਹੋਸਪੀਟਲ ਵੀ ਖੁੱਲ੍ਹ ਚੁੱਕਿਆ ਹੈ ਜਿੱਥੇ ਕਿ ਕੈਂਸਰ ਦਾ ਇਲਾਜ ਹੁੰਦਾ ਹੈ ਅਤੇ ਹੁਣ ਮਰੀਜ਼ਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਬਿਜਲੀ ਨਾਲ ਸੰਬੰਧਿਤ ਸਾਨੂੰ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸਨ ਜੋ ਕਿ ਹੁਣ ਸਾਡੀਆਂ ਉਹ ਵੀ ਦਿੱਕਤਾਂ ਪੂਰੀਆਂ ਹੋਣ ਸਾਨੂੰ ਚੌਵੀ ਘੰਟੇ ਬਿਜਲੀ ਮਿਲਦੀ ਹੈ ਅਤੇ ਬਹੁਤ ਹੀ ਘੱਟ ਕੱਟ ਲੱਗਦੇ ਹਨ ਜਿਸ ਨਾਲ ਸਾਡਾ ਸੰਚਾਈ ਫਸਲਾਂ ਨੂੰ ਪਾਣੀ ਬੜੇ ਵਧੀਆ ਤਰੀਕੇ ਨਾਲ ਅਸੀਂ ਦਿੰਦੇ ਹਾਂ ਖਾਣਾ ਪੀਣਾ ਅੱਜ ਕੱਲ੍ਹ ਸਾਡੇ ਖਾਣ ਪੀਣ ਵਿੱਚ ਵੀ ਬਹੁਤ ਬਦਲਾਅ ਆਏ ਹਨ ਅੱਜ ਕੱਲ੍ਹ ਖਾਣੇ ਖਾਣੇ ਵਿੱਚ ਪ੍ਰੋਡਕਟ ਬਹੁਤ ਵਧੀਆ ਆਏ ਹਨ ਜੋ ਕਿ ਡੱਬਾ ਬੰਦ ਹਨ ਜਿਹੜੇ ਲੋਕ ਕੰਮਾਂ 'ਤੇ ਜਾਂਦੇ ਹਨ ਉਹ ਡੱਬਾ ਬੰਦ ਖਾਣਾ ਲੈ ਕੇ ਆਉਂਦੇ ਹਨ ਅਤੇ ਉਸ ਨਾਲ ਹੀ ਆਪਣਾ ਖਾਣਾ ਪੀਣਾ ਕਰਦੇ ਹਨ ਸੀਮੇਂਟ ਖੇਤਰ ਵਿੱਚ ਸੀਮੇਂਟ ਪਹਾੜੀ ਖੇਤਰਾਂ ਵਿੱਚੋਂ ਸੀਮੇਂਟ ਦਾ ਰੁਜ਼ਗਾਰ ਲੱਗਿਆ ਹੈ ਜੋ ਕਿ ਸਾਡੇ ਦੇਸ਼ ਵਿੱਚ ਅਤੇ ਬਾਹਰਲੇ ਦੇਸ਼ਾਂ ਨੂੰ ਵੀ ਅਸੀਂ ਸੀਮੇਂਟ ਦਾ ਭੁਗਤਾਨ ਕਰਦੇ ਹਾਂ ਹਥਿਆਰ ਸਾਡੇ ਦੇਸ਼ ਵਿੱਚ ਹਥਿਆਰ ਵੀ ਬਣਦੇ ਹਨ ਜੋ ਕਿ ਬਹੁਤ ਵਧੀਆ ਹਨ ਅਤੇ ਅਸੀਂ ਇਹ ਹਥਿਆਰ ਆਪਣੇ ਫੌਜ ਨੂੰ ਅਤੇ ਹੋਰ ਕੰਮ ਵਾਸਤੇ ਵੀ ਵਰਤਦੇ ਹਾਂ ਅਤੇ ਅਸੀਂ ਕੀ ਇਸ ਦਾ ਇਹਨਾਂ ਹਥਿਆਰਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪਹੁੰਚਾਉਂਦੇ ਹਾਂ ਦਵਾਈਆਂ ਸਾਡੇ ਦੇਸ਼ ਵਿੱਚ ਕਈ ਤਰ੍ਹਾਂ ਦੀਆਂ ਇਹੋ ਜਿਹੀਆਂ ਦਵਾਈਆਂ ਦਾ ਵਿਕਾਸ ਹੋਇਆ ਹੈ ਜਿਸ ਨਾਲ ਕਿ ਕੈਂਸਰ ਵਰਗੇ ਭਿਆਨਕ ਇਲਾਜਾਂ ਦੀ ਵੀ ਜਾਂਚ ਕੀਤੀ ਜਾਂਦੀ ਹੈ ਜਿਸ ਨਾਲ ਕਿ ਬਹੁਤ ਸਾਰੇ ਲੋਕ ਠੀਕ ਹੋਏ ਹਨ ਬੈਂਕਿੰਗ ਬੈਂਕਿੰਗ ਨਾਲ ਸਾਡੀ ਪਹਿਲਾਂ ਲੋਕ ਭੁਗਤਾਨ ਪੈ ਨਗਦ ਦਿੰਦੇ ਸਨ ਜਾਂ ਨਾਲ ਨਗਦ ਪੈਸੇ ਲੈ ਕੇ ਜਾਂਦੇ ਸਨ ਪਰ ਅੱਜ ਕੱਲ੍ਹ ਲੋਕ ਭੁਗਤਾਨ ਡਿਜੀਟਲ ਕਰਦੇ ਹਨ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪੈਸੇ ਡਿਜੀਟਲ ਤਰੀਕੇ ਨਾਲ ਹੀ ਭੁਗਤਾਨ ਕਰਦੇ ਹਨ ਜੋ ਕਿ ਨਗਦ ਪੈਸਾ ਨਾਲ ਲੈ ਕੇ ਨਹੀਂ ਜਾਂਦੇ